ਪੰਜਾਬ ਵਿੱਚ ਨਿਆਂਪਾਲਕਾ ਦੀ ਭੂਮਿਕਾ ਬਹੁਤ ਵੱਡੀ ਹੈ ਕੋਈ ਵੀ ਵਿਧਾਨ ਸਭਾ ਲੈਜਿਸਲੇਟਿਵ ਕਾਨੂੰਨ ਬਣਾਉਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਕਾਰਜ ਪਾਲਿਕਾ ਕੋਲ ਜਾਂਦੀ ਹੈ ਉਸ ਤੋਂ ਬਾਅਦ ਜੇ ਕੋਈ ਖਾਮੀਆਂ ਹੁੰਦੀਆਂ ਕਾਨੂੰਨਾਂ ਦੇ ਵਿੱਚ ਤਾਂ ਜਿਹੜੀ ਨਿਆਂਪਾਲਕਾ ਉਹਨੂੰ ਚੇਂਜ ਕਰਦੀ ਏ ਰੱਦ ਕਰਦੀ ਏ ਜਾਂ ਤਾਂ ਅੰਕਿਤ ਬਿੰਦੂ ਲਗਾਉਂਦੀ ਹੈ ਠੀਕ ਹੈ ਨਿਆਂਪਾਲਕਾ ਦਾ ਇਸ ਚੀਜ਼ ਵਿੱਚ ਬਹੁਤ ਵੱਡਾ ਯੋਗਦਾਨ ਆ ਅਤੇ ਵਿਧਾਨ ਸ ਕੋਈ ਵੀ ਕਾਨੂੰਨ ਆ ਸਭ ਤੋਂ ਪਹਿਲਾਂ ਵਿਧਾਨ ਸਭਾ ਲੈਜੀਸਲੇਟਿਵ ਕੌਂਸਲ ਨੂੰ ਬਣਾਉਂਦੀ ਹੈ ਤਾਂ ਉਹ ਜਦੋਂ ਕਾਨੂੰਨ ਬਣਦਾ ਤਾਂ ਪਾਸ ਹੋਣ ਵਾਸਤੇ ਬਿੱਲ ਉਹ ਜਾਂਦਾ ਕਾਰਜਪਾਲਿਕਾ ਦੇ ਕੋਲੇ ਠੀਕ ਹੈ ਕਾਰਜਪਾਲਿਕਾ ਉਹਨੂੰ ਪਾਸ ਹੋਣ ਵਾਸਤੇ ਅੱਗੇ ਹਾਇਰ ਅਥੋਰਟੀ ਲਾਈਕ ਗਵਰਨਰ ਕੋਲੇ ਪ੍ਰੈਜੈਂਟ ਕੋਲੇ ਪ੍ਰੈਜੀਡੈਂਟ ਕੋਲੇ ਭੇਜਦੀ ਹੈ ਠੀਕ ਹੈ ਤਾਂ ਉਹਦੇ ਵਿੱਚ ਕੋਈ ਵੀ ਅਗਰ ਕਾਨੂੰਨ ਦੇ ਵਿੱਚ ਕੋਈ ਵੀ ਇਹਨਾਂ ਨੂੰ ਖਰਾਬੀ ਲੱਗਦੀ ਹੈ ਤਾਂ ਉਹ ਹਾਈ ਕੋਰਟ ਸੁਪਰੀਮ ਕੋਰਟ ਦਾ ਰੁੱਖ ਅਪਣਾਉਂਦੀਆਂ ਹਨ ਤਾਂ ਕਰਕੇ ਨਿਆਂਪਾਲਕਾ ਪੰਜਾਬ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਓਕੇ ਧੰਨਵਾਦ